ਜਿਵੇਂ ਕਿ ਪੁਲੀਸ ਵਕੀਲ ਪੰਚਾਇਤ ਸਰਪੰਚ ਆਦਿ ਦਾ ਬਹੁਤ ਹੀ ਸਾਨੂੰ ਸਾਹਮਣਾ ਕਰਨਾ ਤਾਂ ਪਿਆ ਨਹੀਂ ਜੇਕਰ ਕਦੇ ਸਾਨੂੰ ਕਰਨਾ ਵੀ ਪਿਆ ਏ ਤਾਂ ਸਾਨੂੰ ਬਹੁਤ ਜ਼ਿਆਦਾ ਮੁਸੀਬਤਾਂ ਆਈਆਂ ਏ ਤਾਂ ਬਹੁਤ ਜ਼ਿਆਦਾ ਮੁਸ਼ਕਿਲਾਂ ਪੈ ਪੈਦਾ ਹੋਈਆਂ ਏ ਕਿਉਂਕਿ ਅੱਜ ਕੱਲ੍ਹ ਨਾ ਵਕੀਲਾਂ ਕੋਲ ਸੁਣਵਾਈ ਹੈ ਨਾ ਪੁਲੀਸ ਵਾਲਿਆਂ ਕੋਲ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਪੰਚਾਇਤਾਂ ਵੀ ਕਿੰਨੇ ਕੁ ਕੰਮ ਕਰਦੀਆਂ ਹਨ ਅੱਜ ਕੱਲ੍ਹ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਹਨ